ਸਾਡੇ ਭਾਰਤ ਆਪਣਾ ਦੇਸ਼ ਵਿੱਚ ਬਹੁਤ ਸਾਰੇ ਵਪਾਰੀ ਉਦਯੋਗਪਤੀ ਕਿੱਤਾ ਆਪਣਾ ਕਿਰਤ ਲੋਕ ਰਹਿੰਦੇ ਹਨ ਅੱਛਾ ਇਹਨਾਂ ਲੋਕਾਂ ਨੇ ਵੀ ਸਾਡੇ ਦੇਸ਼ ਦੀ ਉੱਨਤੀ ਅਤੇ ਤਰੱਕੀ ਵਾਸਤੇ ਵੱਖ ਵੱਖ ਸਮੇਂ ਵਿੱਚ ਮੱਲਾਂ ਮਾਰੀਆਂ ਹਨ ਜਿਵੇਂ ਅੱਛਾ ਬਾਨੀਆਂ ਨੇ ਆਪਣੇ ਦੇਸ਼ ਦੇ ਵਿੱਚ ਪ੍ਰੋਟੈਕਟ ਨਵੇਂ ਆਉਂਦੇ ਨੇ ਕੰਪਨੀਆਂ ਖੋਲੀਆਂ ਨੇ ਆਪਣੇ ਦੇਸ਼ ਨੂੰ ਉੱਨਤੀ ਦੇ ਤਰੱਕੀ ਦੇ ਰਾਹ 'ਤੇ ਖੜ੍ਹਨ ਵਾਸਤੇ ਦੇਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਇਹਦੇ ਨਾਲ ਹੀ ਜਿਵੇਂ ਆਪਣਾ ਖੇਤੀਬਾੜੀ ਦੇ ਅੱਛਾ ਵਿੱਚ ਜਾਂ ਜਿਹੜੇ ਕਿਸਾਨ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਆਪਣਾ ਕਰਕੇ ਫਸਲ ਚੰਗੀ ਆਪਣਾ ਕਰਕੇ ਦੇਸ਼ ਦੇ ਵਿੱਚ ਅਨਾਜ ਅੰਨ ਦੀ ਪੈਦਾਵਾਰ ਭਰਪੂਰ ਕੀਤੀ ਹੈ ਅਤੇ ਉਸ ਦੇ ਨਾਲ ਜਿਹੜੇ ਆਪਣੇ ਦੇਸ਼ ਦੇ ਵਿੱਚ ਕਾਰਖਾਨੇ ਫੈਕਟਰੀਆਂ ਇੰਡਸਟਰੀਆਂ ਨੇ ਵੱਖ ਵੱਖ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਹਨ ਆਪਣੇ ਜਿਹਦੇ ਨਾਲ ਅੱਜ ਸਾਡਾ ਆਪਣਾ ਦੇਸ਼ ਉੱਨਤੀ ਅਤੇ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਅਤੇ ਪਰਮਾਤਮਾ ਕਰਕੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਵੀ ਸਾਡਾ ਜਿਹੜਾ ਭਾਰਤ ਆਪਣਾ ਦੇ ਵੀ ਦੇਸ਼ ਹੈ ਕਿ ਇਹ ਇੱਕ ਵਰਲਡ ਦਾ ਐਸਾ ਆਪਣਾ ਦੇਸ਼ ਉਹ ਜਾਣੀ ਕਿ ਹੋਵੇ ਜਿਹਦੇ ਅੰਦਰ ਹਰੇਕ ਕਿਸਮ ਦੀ ਅੰਡਸਟਰੀ ਫੈਕਟਰੀ ਖੇਤੀਬਾੜੀ ਐਗਰੀਕਲਚਰ ਵੀ ਹਰੇਕ ਪੱਖ ਤੋਂ ਹੀ ਉੱਪਰ ਨੂੰ ਮਕੀ ਆਪਣਾ ਜਾਵੇ